ਹਾਂਜੀ ਮੈਂ ਰਾਤ ਵੇਲੇ ਪੰਛੀ ਦੇਖਣ ਦੀ ਕੋਸ਼ਿਸ਼ ਕੀਤੀ ਹੈ ਅਤੇ ਮੈਨੂੰ ਪੰਛੀ ਅਸਮਾਨ ਉੱਡਦੇ ਅਸਮਾਨ ਵਿੱਚ ਉਡਦੇ ਹੋਏ ਪੰਛੀ ਦੇਖਣ ਦਾ ਸ਼ੁਰੂ ਤੋਂ ਹੀ ਬਚਪਨ ਤੋਂ ਹੀ ਸ਼ੌਂਕ ਸੀ ਮੈਂ ਹੁਣ ਤੱਕ ਵੀ ਅਸਮਾਨ ਵਿੱਚ ਉੱਡਦੇ ਹੋਏ ਪੰਛੀ ਦੇਖਣਾ ਪਸੰਦ ਕਰਦੀ ਹਾਂ ਅਤੇ ਰਾਤ ਵੇਲੇ ਪੰਛੀ ਜੋ ਮੈਨੂੰ ਦਿਖਦੇ ਹਨ ਜਿਵੇਂ ਕਿ ਚੀਲ ਚਮਚੜਿੱਕ ਗਿੱਦ ਅਤੇ ਉੱਲੂ ਪਿੰਡਾਂ ਵਿੱਚ ਜ਼ਿਆਦਾਤਰ ਰਾਤ ਵੇਲੇ ਚਮਚੜਿੱਕ ਦੇਖਣ ਨੂੰ ਮਿਲਦੀਆਂ ਹਨ ਬਚਪਨ ਵਿੱਚ ਮੈਂ ਆਪਣੇ ਨਾਨਕੇ ਘਰ ਜਦ ਜਾਂਦੀ ਸਾਂ ਤਾਂ ਪਿੰਡਾਂ ਵਿੱਚ ਉੱਥੇ ਚਮਚੜਿੱਕ ਹੀ ਜ਼ਿਆਦਾਤਰ ਦੇਖਣ ਨੂੰ ਮਿਲਦੀਆਂ ਸਨ ਉਹ ਰਾਤ ਦੇ ਹਨੇਰੇ ਵਿੱਚ ਉੱਡਦੀਆਂ ਹਨ ਅਤੇ ਹਨੇਰੇ ਵਿੱਚ ਹੀ ਆਪਣਾ ਖਲ ਖੂੰਜਿਆਂ ਵਿੱਚ ਵਾਸ ਕਰਦੀਆਂ ਹਨ ਇੱਕ ਵਾਰ ਦੀ ਗੱਲ ਹੈ ਸਾਡੇ ਖੇਤਾਂ ਵਿੱਚ ਅੰਬ ਦਾ ਬੂਟਾ ਸੀ ਅੰਬਾਂ ਦੇ ਬਾਗ ਵਿੱਚ ਮੈਂ ਉੱਲੂ ਨੂੰ ਦਰੱਖਤ 'ਤੇ ਬੈਠੇ ਹੋਏ ਦੇਖਿਆ ਅਤੇ ਮੈਨੂੰ ਜ਼ੋਰ ਜ਼ੋਰ ਦੀ ਇਸ ਪੰਛੀ ਦੇ ਹੱਸਣ ਦੀ ਜਾਂ ਕੋਈ ਖੁਸ਼ ਹੋਣ ਦੀ ਆਵਾਜ਼ ਆ ਰਹੀ ਸੀ ਜਦ ਮੈਂ ਉਸ ਨੂੰ ਬਾਹਰ ਨਿਕਲ ਕੇ ਦੇਖਿਆ ਤਾਂ ਮੈਨੂੰ ਬੜੀ ਹੀ ਦੂਰ ਇੱਕ ਉੱਲੂ ਹੱਸਦਾ ਹੋਇਆ ਨਜ਼ਰ ਆਇਆ ਅਤੇ ਉਸਨੂੰ ਦੇਖ ਕੇ ਮੇਰਾ ਮਨ ਬਹੁਤ ਖੁਸ਼ ਹੋਇਆ